ਭੰਗੜਾ ਪਾਉਣ ਵਾਲੇ ਦੇ ਕੁੜਤਾ ਚਾਦਰਾ ਗਲ ਵਿੱਚ ਕੈਂਠਾ ਅਤੇ ਸੰਮਾ ਵਾਲੀ ਡਾਂਗ ਹੁੰਦੀ ਹੈ ਅਤੇ ਉਹਨਾਂ ਦੀ ਪੁਸ਼ਾਕ ਸਭ ਤੋਂ ਅਲੱਗ ਹੁੰਦੀ ਹੈ ਅਤੇ ਦੂਰੋਂ ਹੀ ਪਹਿਚਾਣੇ ਜਾਂਦੇ ਹਨ ਕਿ ਇਹ ਭੰਗੜਾ ਪਾਉਣ ਵਾਲੀ ਟੀਮ ਹੈ ਅਤੇ ਉਹ ਇਸ ਪੁਸ਼ਾਕ ਦੇ ਨਾਲ ਅਤੇ ਇਹਨਾਂ ਚੀਜ਼ਾਂ ਦੇ ਨਾਲ ਆਕਰਿਸ਼ਤ ਕਰਦੇ ਹਨ ਸਭ ਨੂੰ ਤੁਰਲੇ ਵਾਲੀ ਪੱਗ ਹੁੰਦੀ ਹੈ ਮਾਵੇ ਵਾਲੀ ਪੱਗ ਤੁਰਲੇ ਵਾਲੀ ਬੰਨਦੇ ਹਨ